ਨਮਸ਼ਕਾਰ ਮੇਰਾ ਨਾਮ ਸ਼ਾਕਸ਼ੀ ਹੈ ਅਤੇ ਮੈਂ ਪਠਾਨਕੋਟ ਜਿਲ੍ਹੇ ਦੀ ਰਹਿਣ ਵਾਲੀ ਹਾਂ ਜਿਵੇਂ ਕਿ ਅਸੀਂ ਦੇਖਿਆ ਕਿ ਪੰਜਾਬੀ ਭਾਸ਼ਾ ਦੀ ਬਰ ਪੰਜਾਬੀ ਲੋਕ ਜਿਹੜੇ ਹਨ ਉਹ ਆਪਣੀ ਭਾਸ਼ਾ ਦੀ ਵਰਤੋਂ ਦੂਜਿਆ ਨਾਲ ਗੱਲ ਬਾਤ ਕਰਨ ਵਿੱਚ ਕਾਫ਼ੀ ਕਰਦੇ ਹਨ ਪਰ ਜੇਕਰ ਦੂਸਰਿਆਂ ਨੂੰ ਪੰਜਾਬੀ ਭਾਸ਼ਾ ਨਾ ਆਉਂਦੀ ਹੋਵੇ ਤਾਂ ਵੀ ਪੰਜਾਬੀ ਲੋਕ ਆਪਣੀ ਗੱਲ ਬਾਤ ਹਮੇਸ਼ਾ ਪੰਜਾਬੀ ਵਿੱਚ ਹੀ ਕਰਦੇ ਹਨ ਕਿਉਂਕਿ ਪੰਜਾਬੀ ਉਹਨਾਂ ਦੀ ਮਾਤ ਭਾਸ਼ਾ ਹੈ ਉਹ ਇਹ ਪਰਿਆਸ ਕਰਦੇ ਹਨ ਕਿ ਦੂਸਰੇ ਲੋਕ ਉਹਨਾਂ ਦੀ ਭਾਸ਼ਾ ਨੂੰ ਸਮਝ ਸਕਣ ਅਤੇ ਅਗਰ ਉਹਨਾਂ ਨੂੰ ਉਹ ਚੀਜ਼ ਸਮਝ ਨਹੀਂ ਆਉਂਦੀ ਤਾਂ ਉਹ ਇਸ਼ਾਰਿਆਂ ਰਾਹੀਂ ਵੀ ਉਹਨਾਂ ਨੂੰ ਸਮਝਾ ਸਕਦੇ ਹਨ ਜਾਂ ਫਿਰ ਉਹ ਕੁਝ ਸ਼ਬਦ ਵਿੱਚੋਂ ਉਹਨਾਂ ਦੀ ਭਾਸ਼ਾ ਦੇ ਸ਼ ਦੇ ਯੂਜ ਕਰਕੇ ਵੀ ਆਪਣੀ ਗੱਲ ਉਹਨਾਂ ਤੱਕ ਪਹੁੰਚਾ ਸਕਦੇ ਹਨ ਇਸ ਤਰ੍ਹਾਂ ਹੀ ਪੰਜਾਬੀ ਲੋਕ ਆਪਣੀ ਭਾਸ਼ਾ ਦੀ ਵਰਤੋਂ ਕਰਕੇ ਦੂਸਰਿਆਂ ਨਾਲ ਗੱਲ ਬਾਤ ਕਰ ਸਕਦੇ ਹਨ ਅਤੇ ਉਹਨਾਂ ਨੂੰ ਆਪਣੀ ਭਾਸ਼ਾ ਬਾਰੇ ਸਭ ਕੁਛ ਚੰਗੀ ਤਰ੍ਹਾਂ ਸਮਝਾ ਸਕਦੇ ਹਨ ਪੰਜਾਬੀ ਆਪਣੀ ਭਾਸ਼ਾ ਮਾਤ ਭਾਸ਼ਾ ਹੀ ਬੋਲਦੇ ਹਨ ਜਿਹੜੀ ਕਿ ਉਹਨਾਂ ਦੀ ਭਾਸ਼ਾ ਹੈ ਪੰਜਾਬੀ ਪੰਜਾਬੀ ਲੋਕ ਕਦੇ ਵੀ ਆਪਣੀ ਭਾਸ਼ਾ ਤੋਂ ਵੱਖ ਨਹੀਂ ਹੁੰਦੇ ਉਹ ਆਪਣੀ ਹੀ ਭਾਸ਼ਾ ਦਾ ਯੂਜ ਕਰਦੇ ਹਨ ਧੰਨਵਾਦ